ਹਾਂ ਸਾਹਿਲ ਮੈਂ ਪੰਕਜ ਗੱਲ ਕਰ ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਕਿਵੇਂ ਹੋ ਠੀਕ ਹੋ ਬਸ ਵਧੀਆ ਉਹ ਕੱਲ੍ਹ ਰਿਜ਼ਲਟ ਆ ਗਿਆ ਸੀ ਆਪਣਾ ਗ੍ਰੈਜੂਏਸ਼ਨ ਦਾ ਯਾਰ ਹਾਂ ਹਾਂ ਆ ਗਿਆ ਸੀਗਾ ਮੈਂ ਚੈੱਕ ਕੀਤਾ ਸੀ ਦੋਵਾਂ ਦਾ ਆਪਾਂ ਦੋਵੇਂ ਨਹੀਂ ਨਹੀਂ ਮੈਂ ਵੇਖ ਲਿਆ ਸੀਗਾ ਆਪਾਂ ਦੋਵੇਂ ਕਲੀਅਰ ਹੈਗੇ ਹਾਂ ਤਾਂ ਮੈਂ ਇਹ ਪੁੱਛਣ ਲਈ ਹਾਂਜੀ ਹਾਂਜੀ ਮੈਂ ਇਹ ਪੁੱਛਣ ਲਈ ਫੋਨ ਕੀਤਾ ਸੀਗਾ ਯਾਰ ਹੁੰ ਨਹੀਂ ਇਸ ਵਾਰ ਕਲੀਅਰ ਹੋ ਗਿਆ ਮੈਂ ਚੈੱਕ ਕੀਤਾ ਸੀ ਕੱਲ੍ਹ ਹੀ ਅਤੇ ਮੈਂ ਇਹ ਮੈਂ ਇਹ ਪੁੱਛ ਰਿ ਹਾਂ ਹਾਂ ਤੁਹਾਨੂੰ ਵੀ ਯਾਰ ਅਤੇ ਮੈਂ ਇਹ ਪੁੱਛਣ ਲਈ ਫੋਨ ਕੀਤਾ ਸੀਗਾ ਮੈਂ ਕਿਹਾ ਹੁਣ ਯਾਰ ਆਪਾਂ ਕੋਈ ਕੋਪੀਟੀਸ਼ਿੰਗ ਅਗਜ਼ਾਮ ਦੀ ਤਿਆਰੀ ਤਿਉਰੀ ਵਾਸਤੇ ਕੋਈ ਕੋਚਿੰਗ ਕੁਚਿੰਗ ਵੇਖੀਏ ਕਿਉਂਕਿ ਫ਼ਾਜ਼ਿਲਕਾ ਤਾਂ ਯਾਰ ਆਪਣੇ ਹੈ ਨਹੀਂ ਇੰਨਾ ਸਿਸਟਮ ਹਾਂ ਉਹ ਤਾਂ ਹੀ ਮੈਂ ਪੁੱਛਿਆ ਸੀ ਕਿਸੇ ਕੋਲੋਂ ਕੋਚਿੰਗ ਵਗੈਰਾ ਦਾ ਅਤੇ ਬਠਿੰਡਾ ਕੋਚਿੰਗ ਦਾ ਪੁੱਛਿਆ ਸੀਗਾ ਮੈਂ ਕਿਹਾ ਯਾਰ ਬਠਿੰਡਾ ਕਪਿਲ ਵਾਲੇ ਹੈਗੇ ਹੈ ਇੱਕ ਮਤਲਬ ਹਾਈ ਪ੍ਰੋਫਾਈਲ ਹੈ ਸਿਸਟਮ ਉਹਨਾਂ ਦਾ ਤਾਂ ਮਤਲਬ ਛੇ ਨਹੀਂ ਫ਼ਾਜ਼ਿਲਕਾ ਤਾਂ ਨਹੀਂ ਹੋਣਾ ਯਾਰ ਕੰਮ ਫ਼ਾਜ਼ਿਲਕਾ ਤਾਂ ਇਹ ਹੈ ਵੀ ਆਪਾਂ ਨਹੀਂ ਲੈਵਲ ਹੀ ਘੱਟ ਹੈ ਜਿਵੇਂ ਮਤਲਬ ਬਹੁਤ ਘੱਟ ਲੈਵਲ ਦਾ ਸਿਸਟਮ ਹੈ ਇਹ ਓ ਜੇ ਕਪਿਲ ਵਾਲੇ ਤਾਂ ਇਹ ਮੈਂ ਉੱਧਰ ਪਤਾ ਕੀਤਾ ਸੀਗਾ ਕਿਉਂਕਿ ਜਿਵੇਂ ਰਿਜ਼ਲਟ ਆਇਆ ਨਾ ਮੈਂ ਤਾਂ ਕਿਉਂਕਿ ਮੈਨੂੰ ਤਾਂ ਪਤਾ ਸੀਗਾ ਵੀ ਆਪਾਂ ਕਲੀਅਰ ਹੋ ਜਾਣਾ ਵੀ ਆਪਾਂ ਪੋਜ਼ਟਿਵ ਥਿੰਕਿੰਗ ਕਰਕੇ ਚੱਲਦੇ ਮੈਂ ਪਹਿਲਾਂ ਹੀ ਪਤਾ ਕਰ ਲਿਆ ਸੀ ਕੋਚਿੰਗ ਦਾ ਅਤੇ ਮੈਂ ਉੱਧਰ ਪਤਾ ਕੀਤਾ ਸੀ ਬਠਿੰਡੇ ਗੁਰੂ ਨਾਨਕ ਹਾਂ ਨਾਨਕੇ ਮੇਰੇ ਬਠਿੰਡੇ ਹੈਗੇ ਹੈ ਤਾਂ ਉੱਧਰ ਪਤਾ ਕਰਵਾਇਆ ਸੀਗਾ ਬਈ ਕੀ ਨਾਮ ਹੈ ਕਿਹੜੇ ਹੈਗੇ ਹੈ ਕੋਚਿੰਗ ਸੈਂਟਰਸ ਅਤੇ ਉਹ ਉਹਨਾਂ ਨੇ ਕਿਹਾ ਵੀ ਕਪਿਲ ਵਾਲੇ ਜਿਹੜੇ ਹੈਗੇ ਹੈ ਉਹ ਛੇ ਮਹੀਨਿਆਂ ਦੇ ਵਿੱਚ ਤੁਹਾਨੂੰ ਜਿਵੇਂ ਤੁਸੀਂ ਅਡਮਿਸ਼ਨ ਲੈ ਲਈ ਨਾ ਤੁਹਾਨੂੰ ਛੇ ਮਹੀਨਿਆਂ ਦੇ ਵਿੱਚ ਜੋਬ ਲਗਵਾ ਕੇ ਉਸ ਤੋਂ ਬਾਅਦ ਹੀ ਉਹ ਕਰਨਗੇ ਨਹੀਂ ਤਾਂ ਸਾਰੇ ਪੈਸੇ ਵਾਪਿਸ ਵਿਆਜ਼ ਸਮੇਤ ਹਾਂਜੀ ਹਾਂਜੀ ਨਾ ਲੱਗੇ ਤਾਂ ਵਾਪਿਸ ਅਤੇ ਉੱਧਰ ਦਾ ਪਤਾ ਨਹੀਂ ਕਿਹੜੇ ਮੋਨੂ ਸਰ ਹੈਗੇ ਹੈ ਇੱਕ ਉਹ ਯੂ ਪੀ ਐਸ ਸੀ ਤਿੰਨ ਵਾਰੀ ਕਰੈਕ ਕਰ ਚੁੱਕੇ ਹੈ ਹਾਂਜੀ ਹਾਂਜੀ ਯੂ ਪੀ ਐਸ ਸੀ ਤਿੰਨ ਵਾਰ ਹੋਰ ਬਾਕੀ ਤੁਸੀਂ ਵੇਖੋ ਜੀ ਤੁਸੀਂ ਤੇਰਾ ਕੀ ਸਲਾਹ ਹੈ ਵੀਰੇ ਫਿਰ ਨਹੀਂ ਬਠਿੰਡੇ ਪਤਾ ਕੀ ਗੱਲ ਹੈ ਕੋਚਿੰਗ ਦਾ ਕੋਈ ਫ਼ਰਕ ਨਹੀਂ ਪੈਂਦਾ ਕੋਚਿੰਗ ਉੰਨੀ ਕੀ ਹੈ ਅਤੇ ਮੇਨ ਬਸ ਇਹ ਹੁੰਦਾ ਹੈ ਵੀ ਚਲੋ ਥੋੜ੍ਹਾ ਹੈਲੋ ਅੱਛਾ ਮੈਂ

ਨਹੀਂ ਨਾਨਕੇ ਤਾਂ ਨੇੜੇ ਹੈ ਨਾਨਕੇ ਰੋਟੀ ਪਾਣੀ ਵਾਲਾ ਕੋਈ ਹੈ ਨਹੀਂ ਆਪਾਂ ਨੂੰ ਬਠਿੰਡੇ ਹੀ ਰਹਿਣਾ ਪਵੇਗਾ ਹਾਂ ਉਹ ਬਠਿੰਡੇ ਹੀ ਖਰਚਾ ਹਾਂ ਬਠਿੰਡੇ ਰਹਾਂ ਉਹ ਯਾਰ ਕੋਚਿੰਗ ਦਾ ਤਾਂ ਕੋਈ ਖ਼ਾਸ ਫ਼ਰਕ ਨਹੀਂ ਉੱਧਰ ਵੀ ਉਹਨਾਂ ਨੇ ਵੀਹ ਹਜ਼ਾਰ ਕਿਹਾ ਇੱਧਰ ਪ ਇੱਧਰ ਵੀ ਵੀਹ ਹਜ਼ਾਰ ਲੱਗਣਾ ਹੈ ਗੱਲ ਹੈ ਬਸ ਰਹਿਣ ਸਹਿਣ ਦੀ ਹੈਗੀ ਬਟ ਉੱਥੇ ਆਪਾਂ ਨੂੰ ਕੋਚਿੰਗ ਥੋੜ੍ਹੀ ਵਧੀਆ ਅਰੋੜਾ ਕਲਾਸ ਵੀ ਪਤਾ ਕੀਤਾ ਸੀਗਾ ਬਟ ਉੱਥੇ ਥੋੜ੍ਹਾ ਰਸ਼ ਜ਼ਿਆਦਾ ਹੈ ਯਾਰ ਐਕਚੁਲੀ ਦੇ ਵਿੱਚ ਹਾਂ ਉੱਥੇ ਉੱਥੇ

ਹਾਂ ਉੱਥੇ ਰਸ਼ ਜ਼ਿਆਦਾ ਇੱਥੇ ਫਿਰ ਵੀ ਸਹੀ ਹੈ ਕੰਮ ਇੱਥੇ ਕ ਸੂਤ ਆਜੂਗਾ ਆਪਾਂ ਨੂੰ ਇੱਥੇ ਅਜੇ ਨਵਾਂ ਖੁੱਲ੍ਹਿਆ ਹਾਈ ਪ੍ਰੋਫਾਈਲ ਜਿਹੜੇ ਸਾਰੇ ਇੱਕ ਮੈਮ ਹੈਗੇ ਦੀਕਸ਼ਾ ਮੈਮ ਹੈ ਉਹ ਵੀ ਮਤਲਬ ਵਧੀਆ ਹੈਗੇ ਹੈ ਬੈਂਕ 'ਚ ਉਹ ਪੀ ਓ ਲੱਗੇ ਹੋਏ ਹੈ ਉਹ ਵੀ ਵਧੀਆ ਹੈਗੇ ਹੈ ਹਾਂ ਮੈਂ ਮੈਂ ਇੱਕ ਸਟਾਫ ਦਾ ਸਾਰਾ ਪਤਾ ਕਰਕੇ ਹੀ ਤੈਨੂੰ ਦੱਸਿਆ ਮੈਂ ਕਿਹਾ ਯਾਰ ਆਪਾਂ ਕੱਚੀ ਗੱਲ ਨਹੀਂ ਕੀਤੀ ਯਾਰ ਹਾਂ ਮੈਂ ਸਾਰਾ ਪਤਾ ਕਰ ਲਿਆ ਕਪਿਲ ਕਪਿਲ ਸਰ ਆਪ ਦਾ ਤਾਂ ਨਹੀਂ ਮੈਨੂੰ ਉਹਨਾਂ ਦੀ ਕੁਆਲੀਫਿਕੇਸ਼ਨ ਪਤਾ ਲੱਗੀ ਜ਼ਿਆਦਾ ਬਟ ਫਿਰ ਵੀ ਚਲੋ ਅਗਰ ਸਟਾਫ ਦਾ ਪਤਾ ਲੱਗ ਗਿਆ ਵੀ ਉਹਨਾਂ ਦਾ ਤਾਂ ਚੱਲੋ ਪੜ੍ਹਨ ਪੜ੍ਹ ਕੇ ਪਤਾ ਲੱਗ ਹੀ ਜਾਵੇਗਾ ਆਪਾਂ ਨੂੰ ਬਾਕੀ ਉਹ ਹਫ਼ਤੇ ਦੀ ਡੈਮੋ ਵੀ ਡੈਮੋ ਵੀ ਦੇਣਗੇ ਹਫ਼ਤੇ ਦੀ ਡੈਮੋ ਦੇਣਗੇ ਉਸ ਤੋਂ ਬਾਅਦ ਆਪਾਂ ਫੀਸ ਵਗੈਰਾ ਕਰਵਾਉਣੀ ਹੈ ਅਤੇ ਫੀਸ ਛੇ ਮਹੀਨੇ ਦੀ ਇਕੱਠੀ ਲੈਣਗੇ ਛੇ ਮਹੀਨੇ 'ਚ ਜੇਕਰ ਤੁਹਾਡਾ ਕਰੈਕ ਨਹੀਂ ਹੁੰਦਾ ਤਾਂ ਛੇ ਮਹੀਨੇ ਬਾਅਦ ਫੀਸ ਤੁਹਾਡੀ ਵਾਪਿਸ ਹਾਂ ਅਤੇ ਬਟ ਇਹ ਹੈ ਚਲੋ ਆਪਾਂ ਹਾਂ ਆਪਾਂ ਜੇ ਕੁਛ ਨਾ ਵੀ ਉੱਥੋਂ ਬਣੇ ਤਾਂ ਆਪਾਂ ਬਹੁਤ ਕੁਛ ਸਿੱਖ ਸਿੱਖ ਸਿੱਖਣ ਨੂੰ ਮਿਲੇਗਾ ਯਾਰ ਆਪਾਂ ਨੂੰ ਆਪਾਂ ਬਾਹਰ ਨਿਕਲਾਂਗੇ ਤਾਂ ਹੀ ਆਪਾਂ ਨੂੰ ਕੁਛ ਨਿਕਲੇਗਾ ਨਾ ਯਾਰ ਠੀਕ ਹੈ ਨਾ ਹਾਂ ਸ਼ਹਿਰ 'ਚ ਲੈ ਕੇ ਨਹੀਂ ਪਤਾ ਲੱਗਣਾ ਹਫ਼ਤੇ ਦੀ ਡੈਮੋ ਫ੍ਰੀ ਹੈ ਫਿਰ ਕਰੀਏ ਫਿਰ ਕੱਲ੍ਹ ਤੋਂ ਪਤਾ ਯਾਰ ਆਪਾਂ ਚਲੀਏ ਫਿਰ ਕੱਲ੍ਹ ਜਾਂ ਪਰਸੋਂ ਪਤਾ ਕਰਕੇ ਆਈਏ ਹਾਂ ਚੱਲ ਫਿਰ ਆਪਾਂ ਕਰਦੇ ਹਾਂ ਫਿਰ ਹੈ ਹਾਂ ਤੂੰ ਆਪਣੀ ਮਮਾ ਪਾਪਾ ਨਾਲ ਡਿਸਕਸ ਕਰ ਲਈ ਤਾਂ ਫਿਰ ਆਪਾਂ ਕਰਦੇ ਹੈ ਸਿਸਟਮ ਹਾਂ ਠੀਕ ਹੈ ਵੀਰੇ ਹਾਂ ਹਾਂ ਹਾਂ ਕੋਚਿੰਗ ਤਾਂ ਲੈਣੀ ਹੈ ਠੀਕ ਹੈ ਵੀਰੇ